ਹਾਂਜੀ ਬੁਣਾਈ ਅਤੇ ਸਿਲਾਈ ਤਕਨੀਕਾਂ ਜਾਂ ਸ਼ੈਲੀਆਂ ਹਨ ਜੋ ਭਵਿੱਖ ਵਿੱਚ ਮੈਂ ਸਿੱਖਣਾ ਚਾਹੁੰਦੀ ਹਾਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜਿੰਨਾਂ ਸਿੱਖੀਏ ਉਹਨਾਂ ਥੋੜ੍ਹਾ ਏ ਪਹਿਲਾਂ ਦਾ ਟਾਈਮ ਕੁਛ ਹੋਰ ਸੀਗਾ ਵੀ ਜਿੰਨਾਂ ਕੁ ਸੀ ਆਉਂਦਾ ਸੀ ਆਪਾਂ ਸੂਟ ਕੱਟਿਆ ਸੀ ਲਿਆ ਪਰ ਅੱਜ ਕੱਲ੍ਹ ਦੇ ਮੋਡਰਨ ਜ਼ਮਾਨੇ ਵਿੱਚ ਇੰਨੀਆਂ ਤਕਨੀਕਾਂ ਆ ਗਈਆਂ ਹਨ ਇੰਨੀਆਂ ਜ਼ਿਆਦਾ ਕਿ ਨਵੀਆਂ ਨਵੀਆਂ ਚੀਜ਼ਾਂ ਦੀ ਕਾਢ ਮਿਲ ਰਹੀ ਹੈ ਜੋ ਕਿ ਅਸੀਂ ਬਹੁਤ ਮੈਨੂੰ ਉਹ ਹੁੰਦਾ ਏ ਕਿ ਮੈਂ ਯੂਟਿਊਬ 'ਤੇ ਕੁਛ ਨਾ ਕੁਛ ਦੇਖਾਂ ਵੀ ਆਹ ਚੀਜ਼ ਦਾ ਡਿਜ਼ਾਈਨ ਕਿੱਦਾਂ ਬਣਦਾ ਏ ਆਹ ਚੀਜ਼ ਜਿਵੇਂ ਕਿ ਗਲੇ ਹੀ ਲਾ ਲਉ ਕਮੀਜ਼ਾਂ ਦੇ ਡਿਜ਼ਾਈਨ ਨਿੱਤ ਦੇ ਨਿੱਤ ਡਿਜ਼ਾਈਨ ਆ ਰਹੇ ਆ ਠੀਕ ਹੈ ਅਤੇ ਉਹਨਾਂ ਦੀ ਬਣਤਰ ਕਿੱਦਾਂ ਏ ਗਲੇ ਕਿੱਦਾਂ ਬਣਾਉਣੇ ਏ ਕਮੀਜ਼ਾਂ ਦੇ ਡਿਜ਼ਾਈਨ ਇਹ ਮੈਨੂੰ ਯੂਟਿਊਬ 'ਤੇ ਮੈਂ ਬਹੁਤ ਮੈਨੂੰ ਚਾਅ ਚੜ੍ਹਦਾ ਕਿ ਮੈਂ ਨਵੀਆਂ ਤੋਂ ਨਵੀਆਂ ਚੀਜ਼ਾਂ ਸਿੱਖਾਂ ਅਤੇ ਜਿਸ ਤਰ੍ਹਾਂ ਕਿ ਸਲਵਾਰਾਂ ਲਾ ਲਉ ਸਲਵਾਰਾਂ ਅੱਜ ਕੱਲ੍ਹ ਧੋਤੀ ਸਲਵਾਰ ਆ ਗਈ ਹੈ ਕੋਈ ਪਟਿਆਲਾ ਸਲਵਾਰ ਤਾਂ ਪਹਿਲਾਂ ਹੁੰਦੀ ਉਹ ਸੀਗੀ ਪਠਾਣੀ ਸਲਵਾਰ ਆ ਗਈ ਹੈ ਇਹ ਚੀਜ਼ਾਂ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇੰਨੀ ਤਕਨੀਕੀ ਆ ਗਈ ਹੈ ਨਵੀਆਂ ਤੋਂ ਨਵੀਆਂ ਕਾਢਾਂ ਆ ਰਹੀਆਂ ਔਰ ਮੇਰਾ ਬਹੁਤ ਜੀ ਕਰਦਾ ਕਿ ਮੈਂ ਨਾ ਯੂਟਿਊਬ 'ਤੇ ਨਵੀਆਂ ਨਵੀਆਂ ਕਾਢਾਂ ਕੱਢਾਂ ਔਰ ਸਿੱਖਾਂ